ਜੇ ਭਾਰਤ ਦੀ ਗੱਲ ਕਰੀਏ ਤਾਂ ਸਾਈਕਲ ਦੇ ਉੱਤੇ ਤਾਂ ਨਹੀਂ ਇਹੋ ਜਿਹੀ ਜਗ੍ਹਾ 'ਤੇ ਗਏ ਕਿਤੇ ਵੀ ਜਿਹ ਇੱਕ ਸਟੇਟ ਤੋਂ ਜਾਂ ਦੂਜੀ ਸਟੇਟ ਦੇ ਵਿੱਚ ਪਰ ਹਾਂ ਛੋਟੇ ਹੁੰਦੇ ਜਦੋਂ ਸਕੂਲ ਪੜ੍ਹਦੇ ਹੁੰਦੇ ਸੀਗੇ ਪਿੰਡ ਤੋਂ ਸਾਡੇ ਜਿਹੜਾ ਸ਼ਹਿਰ ਆ ਕਪੂਰਥਲਾ ਜਿੱਥੇ ਪੜ੍ਹਨ ਜਾਂਦੇ ਸੀ ਕਪੂਰਥਲੇ ਤਕਰੀਬਨ ਸੱਤ ਤੋਂ ਅੱਠ ਕਿਲੋਮੀਟਰ ਦੂਰ ਆ ਸੋ ਟੈਂਨਥ ਤੋਂ ਬਾਅਦ ਪਲੱਸ ਵਨ ਪਲਸ ਟੂ ਦੇ ਵਿੱਚ ਉੱਥੇ ਜ਼ਰੂਰ ਗਿਆਰਵੀਂ ਬਾਰ੍ਹਵੀਂ ਦੇ ਵਿੱਚ ਜਾਂਦੇ ਰਹੇ ਹਾਂ ਸਾਈਕਲ ਦੇ ਉੱਤੇ ਡੇਲੀ ਰੋਜ਼ ਜਾਣਾ ਸਾਈਕਲ ਦੇ ਉੱਤੇ ਸਵੇਰ ਨੂੰ ਟਿਊਸ਼ਨ ਪੜ੍ਹਨ ਵੀ ਬਾਅਦ ਦੇ ਵਿੱਚ ਜਾਣਾ ਸ਼ਾਮ ਨੂੰ ਮਤਲਬ ਦੋ ਤੋਂ ਤਿੰਨ ਗੇੜੇ ਡੇਲੀ ਦੇ ਲੱਗ ਜਾਂਦੇ ਸੀਗੇ ਸਾਈਕਲ ਦੇ ਉੱਤੇ ਸੱਤ ਤੋਂ ਅੱਠ ਕਿਲੋਮੀਟਰ ਹੁੰਦਾ ਸੀਗਾ ਰੋਜ਼ ਦਾ ਕਹਿ ਲਉ ਕਿ ਵੀਹ ਪੱਚੀ ਕਿਲੋਮੀਟਰ ਸਾਈਕਲ ਦੇ ਉੱਤੇ ਕਵਰ ਕਰ ਲਈਦਾ ਸੀਗਾ ਸੋ ਦੋ ਕੁ ਸਾਲ ਐਦਾਂ ਜਾਂਦੇ ਰਹੇ ਸਾਈਕਲ ਦੇ ਉੱਤੇ ਪਰ ਜਿਹੜਾ ਲੰਮਾ ਟੂਰ ਆ ਕੋਈ ਕਿਤੇ ਹੋਰ ਜਗ੍ਹਾ 'ਤੇ ਜਾਣ ਦਾ ਉਹ ਉਹ ਸਾਈਕਲ ਦੇ ਉੱਤੇ ਕਵਰ ਨਹੀਂ ਕੀਤਾ ਹੈਗਾ ਸੋ ਪਰ ਜੇ ਹੁਣ ਜੇ ਔਪਸ਼ਨ ਜੇ ਕਿਤੇ ਸਾਈਕਲ 'ਤੇ ਜਾਣਾ ਹੋਵੇ ਨੇੜੇ ਤੇੜੇ ਸਾਈਕਲਿੰਗ ਕਿਉਂਕਿ ਜ਼ਰੂਰ ਕਰ ਸਕਦੇ ਹਾਂ ਲਾਗੇ ਲਾਗੇ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰੈਕਟਿਸ ਸਵੇਰ ਨੂੰ ਜਾਂ ਜੇ ਸਾਈਕਲਿੰਗ ਕਰਨੀ ਆ ਪਰ ਦੂਰ ਕਿਤੇ ਜਾਣ ਦਾ ਨਹੀਂ ਕਿਉਂਕਿ ਅੱਜ ਕੱਲ੍ਹ ਟਾਈਮ ਦੀ ਵੀ ਜਿਹੜੀ ਸ਼ੋਰਟਏਜ ਦੇ ਕਾਰਨ ਬਾਹਲਾ ਦੂਰ ਵੀ ਨਹੀਂ ਆਪਾਂ ਜਾ ਸਕਦੇ ਹੈਗੇ ਟੂਰ ਦੇ ਉੱਤੇ ਸੋ ਸਾਈਕਲ ਦੇ ਉੱਤੇ ਦੂਰ ਜਾਣਾ ਪਸੰਦ ਨਹੀਂ ਕਰਾਂਗੇ ਨੇੜੇ ਨੇੜੇ ਸਾਈਕਲਿੰਗ ਜ਼ਰੂਰ ਕਰ ਸਕਦੇ ਹਾਂ ਹੁਣ ਵੀ ਪਰ ਦੂਰ ਨਹੀਂ